ਇੱਕੀਵੀਂ ਸਦੀ ਵਿੱਚ ਦੇਖਿਆ ਗਿਆ ਹੈ ਕਿ ਕਿਸਾਨ ਬਹੁਤ ਖੁਦਕੁਸ਼ੀ ਕਰ ਰਹੇ ਹਨ ਇਸ ਪਿੱਛੇ ਅਨੇਕਾਂ ਕਾਰਨ ਹਨ ਅਤੇ ਉਹ ਕਾਰਨ ਜਿਆਦਾਤਰ ਆਰਥਿਕਤਾ ਨੂੰ ਲੈ ਕੇ ਹਨ ਅਸੀਂ ਵੱਖ ਵੱਖ ਕਾਰਨਾਂ ਵੱਲ ਜੇਕਰ ਦੇਖੀਏ ਤਾਂ ਪਹਿਲਾਂ ਕਾਰਨ ਇਹ ਹੈ ਕਿ ਕਿਸਾਨ ਕਰਜ਼ਾ ਚੁੱਕਦਾ ਹੈ ਆਪਣੀ ਫਸਲ ਬੀਜਦਾ ਹੈ ਅਤੇ ਫਸਲ ਬੀਜਣ ਤੋਂ ਬਾਅਦ ਉਸਨੂੰ ਇੰਨਾ ਮੁਨਾਫ਼ਾ ਨਹੀਂ ਹੁੰਦਾ ਕਿ ਉਹ ਕਰਜ਼ੇ ਦੇ ਪੈਸੇ ਵਾਪਿਸ ਕਰ ਸਕੇ ਇਸ ਲਈ ਉਹ ਖੁਦਕੁਸ਼ੀ ਕਰ ਲੈਂਦਾ ਹੈ ਕਿਉਂਕਿ ਕਈ ਵਾਰ ਇਵੇਂ ਹੁੰਦਾ ਹੈ ਕਿ ਮੌਸਮ ਦੀ ਖ਼ਰਾਬੀ ਕਾਰਨ ਫਸਲਾਂ ਖ਼ਰਾਬ ਹੋ ਜਾਂਦੀਆਂ ਹਨ ਅਤੇ ਕਈ ਵਾਰ ਕੀੜਿਆਂ ਦੀ ਬੀਮਾਰੀ ਕਾਰਨ ਸਾਰੀ ਫਸਲ ਖ਼ਰਾਬ ਹੋ ਜਾਂਦੀ ਹੈ ਅਤੇ ਉਹ ਆਪਣੇ ਕਰਜ਼ੇ ਦੀ ਰਕਮ ਚੁਕਾਣ ਵਿੱਚ ਕਾਬਲ ਨਹੀਂ ਹੁੰਦਾ ਇਸ ਨੂੰ ਦੇਖਦਿਆ ਉਹ ਖੁਦਕੁਸ਼ੀ ਵੱਲ ਵੱਧਦਾ ਹੈ ਅਤੇ ਕਈ ਵਾਰ ਇਵੇਂ ਹੁੰਦਾ ਹੈ ਕਿ ਉਹ ਦੇਖਾ ਦੇਖੀ ਵਿੱਚ ਲੱਗ ਕੇ ਦੂਜੇ ਕਿਸਾਨਾਂ ਨੂੰ ਦੇਖ ਕੇ ਕੋਈ ਮਸ਼ੀਨਰੀ ਖ਼ਰੀਦ ਲੈਂਦਾ ਹੈ ਪ੍ਰੰਤੂ ਉਹ ਉਸਨੂੰ ਵਾਪਸ ਕਰਨ ਦੇ ਯੋਗ ਨਹੀਂ ਹੁੰਦਾ ਉਸ ਪੈਸਿਆਂ ਨੂੰ ਵਾਪਿਸ ਕਰਨ ਦੇ ਯੋਗ ਨਹੀਂ ਹੁੰਦਾ ਜੋ ਉਸ ਨੇ ਬੈਂਕ ਤੋਂ ਲਏ ਹਨ ਇਸ ਲਈ ਮੁੱਖ ਤੌਰ 'ਤੇ ਜੇ ਦੇਖਿਆ ਜਾਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਕਿਸਾਨ ਨੂੰ ਸਿਰਫ਼ ਇੱਕ ਮੁੱਦੇ ਉੱਤੇ ਨਿਰਭਰ ਨਹੀਂ ਹੋਣਾ ਚਾਹੀਦਾ ਉਸਨੂੰ ਹੋਰ ਕਿਸਾਨੀ ਦੇ ਨਾਲ ਨਾਲ ਕੋਈ ਹੋਰ ਇਹੋ ਜਿਹਾ ਸਾਧਨ ਵੀ ਤਿਆਰ ਕਰਨਾ ਚਾਹੀਦਾ ਹੈ ਜਿਸ ਉੱਤੇ ਉਹ ਉਸਦੀ ਆਰਥਿਕਤਾ ਨਿਰਭਰ ਹੋਵੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕਿ ਖੇਤੀਬਾੜੀ ਤੋਂ ਇਲਾਵਾ ਉਹ ਮੁਰਗੀ ਪਾਲਣ ਸ਼ੁਰੂ ਕਰ ਸਕਦਾ ਹੈ ਜਾਂ ਦੁੱਧ ਦਾ ਕੰਮ ਸ਼ੁਰੂ ਕਰ ਸਕਦਾ ਹੈ ਜਿਸ ਨਾਲ ਇਵੇਂ ਨਹੀਂ ਹੋਵੇਗਾ ਕਿ ਜੇਕਰ ਉਸ ਦੀ ਫਸਲ ਖ਼ਰਾਬ ਹੋ ਜਾਂਦੀ ਹੈ ਜਾਂ ਬਿਮਾਰੀ ਲੱਗ ਜਾਂਦੀ ਹੈ ਤਾਂ ਉਸਦਾ ਉਸਨੂੰ ਪੈਸਾ ਦੂਜੇ ਸਾਧਨਾਂ ਤੋਂ ਮਿਲਦਾ ਰਹੇਗਾ ਅਤੇ ਇਸ ਤੋਂ ਇਲਾਵਾ ਅਸੀਂ ਇਹ ਕਰ ਸਕਦੇ ਹਾਂ ਕਿ ਸਿਰਫ਼ ਇੱਕ ਫਸਲ ਉੱਤੇ ਨਿਰਭਰ ਨਹੀਂ ਹੋਣਾ ਚਾਹੀਦਾ ਕਿਸਾਨ ਨੂੰ ਆਪਣੇ ਖੇਤਾਂ ਦੇ ਵਿੱਚ ਕਈ ਤਰੀਕੇ ਦੀਆਂ ਫਸਲਾਂ ਉਗਾਉਣੀਆਂ ਚਾਹੀਦੀਆਂ ਹਨ ਜਿਵੇਂ ਕਿ ਸਿਰਫ਼ ਦਾਲਾਂ ਜਾਂ ਬੀਜ ਵਾਲੀਆਂ ਫਸਲਾਂ ਉੱਤੇ ਨਿਰਭਰ ਨਹੀਂ ਹੋਣਾ ਚਾਹੀਦਾ ਜਿਹੜੀਆਂ ਮੌਸਮੀ ਸਬਜ਼ੀਆਂ ਹੁੰਦੀਆਂ ਹਨ ਉਹਨਾਂ ਨੂੰ ਵੀ ਕਿਸਾਨ ਬੀਜ ਸਕਦਾ ਹੈ ਅਤੇ ਉਹ ਸਬਜ਼ੀਆਂ ਉਸ ਦੀ ਆਰਥਿਕਤਾ ਨੂੰ ਵੀ ਵਧੀਆ ਰੱਖਣਗੀਆਂ ਅਤੇ ਕਰਜ਼ਾ ਲੈਣ ਦੀ ਨੌਬਤ ਹੀ ਨਹੀਂ ਆਵੇਗੀ ਅਤੇ ਖੁਦਕੁਸ਼ੀਆਂ ਦਾ ਦਰ ਘੱਟ ਜਾਏਗਾ